ਅਸੀਂ ਪਾਣੀ ਦਾ ਪ੍ਰਬੰਧ ਦਕਾਨ 'ਤੇ ਵੀ ਔਰਡਰ ਕਰਕੇ ਮੰਗਵਾ ਸਕਦੇ ਹਾਂ ਕੈਂਟਾਂ ਰਾਹੀਂ ਵੀ ਮੰਗਵਾ ਸਕਦੇ ਹਾਂ ਪਾਣੀ ਅਸੀਂ ਵੀ ਘਰ ਵਿੱਚ ਟੱਬ ਭਰ ਕੇ ਵੀ ਰੱਖ ਕੇ ਪ੍ਰਬੰਧ ਕਰ ਸਕਦੇ ਹਾਂ ਅਸੀਂ ਟੈਂਕੀਆਂ ਰਾਹੀਂ ਵੀ ਪਾਣੀ ਦਾ ਪ੍ਰਬੰਧ ਕਰ ਸਕਦੇ ਹਾਂ ਬਾਕੀ ਘਰ ਦੇ ਵਿੱਚ ਟੂਟੀ ਲੱਗੀ ਹੁੰਦੀ ਐ ਤਾਂ ਅਸੀਂ ਟੂਟੀ ਰਾਹੀਂ ਵੀ ਪ੍ਰਬੰਧ ਕਰ ਸਕਦੇ